ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਅਨੂਰੀਤ ਦੀ ਮੰਮਾ ਬੋਲ ਰਹੀ ਹਾਂ ਤੁਸੀਂ ਸਪੋਰਟ ਦੇ ਟੀਚਰ ਬੋਲ ਰਹੇ ਤੋਂ ਬਾਗੜੂ ਸਾਹਿਬ ਤੋਂ ਹਾਂਜੀ ਹਾਂਜੀ ਅਸੀਂ ਆਪਣੇ ਬੱਚਿਆਂ ਵਾਸਤੇ ਗੇਮ ਵਿੱਚ ਨਾਂ ਲਿਖਵਾਉਣਾ ਸੀ ਹੂੰ ਹਾਂਜੀ ਉਹ ਫੁੱਟਬਾਲ ਵਿੱਚ ਬਹੁਤ ਵਧੀਆ ਨੇ ਇਹ ਹੀ ਗੇਮ ਰਖਵਾਉਣਾ ਚਾਹੁੰਦੇ ਅਸੀਂ ਕਦੋਂ ਹੋ ਰਹੀਆਂ ਨੇ ਤੁਹਾਡੇ ਸਕੂਲ ਗੇਮਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਜੀ ਵਧੀਆ ਸਾਡਾ ਬੱਚਾ ਬਹੁਤ ਵਧੀਆ ਚੱਲ ਰਿਹਾ ਫੁੱਟਬਾਲ ਦੀ ਗੇਮ ਬਹੁਤ ਵਧੀਆ ਲੱਗਦੀ ਪਸੰਦ ਵੀ ਹੈ ਉਹਨੂੰ ਇਸ ਕਰਕੇ ਅਸੀਂ ਉਹਦੇ ਵਿੱਚ ਹੀ ਨਾਂ ਲਿਖਵਾਵਾਂਗੇ ਹਾਂਜੀ ਹਾਂਜੀ ਬਹੁਤ ਵਧੀਆ ਬੱਚਾ ਸਾਡਾ ਪੜ੍ਹਾਈ 'ਚ ਵੀ ਵਧੀਆ ਆਇਆ ਸੀ ਹਾਂਜੀ ਓਕੇ ਠੀਕ ਹੈ ਜੀ